ਅੰਮ੍ਰਿਤਸਰ ਵਿੱਚ ਕਈ ਤਰ੍ਹਾਂ ਦਾ ਪਕਵਾਨ ਜੋ ਕਿ ਬਹੁਤ ਮਸ਼ਹੂਰ ਹਨ ਜਿਵੇਂ ਕਿ ਕੁਲਚਾ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਲੱਸੀ ਸਵੀਟਸ ਮਿਠਾਈਆਂ ਅਰ ਦਾਲ ਮਖਨੀ ਪਨੀਰ ਬਹੁਤ ਕੁਛ ਹੈ ਜੋ ਫੇਮਸ ਹਾਂ ਅੰਮ ਅੰਮ੍ਰਿਤਸਰ 'ਚ ਜਿੱਦਾਂ ਕਿ ਹੋਰ ਵੀ ਕਾਫੀ ਚੀਜ਼ਾਂ ਨਾ ਜੋ ਅਹਾ ਅੰਮ੍ਰਿਤਸਰ 'ਚ ਬਹੁਤ ਵਧੀਆ ਫੇਮਸ ਆ ਜਿੱਦਾਂ ਪੂੜੀ ਛੋਲੇ ਅ ਕੁਲਚਾ ਛੋਲੇ ਲੱਸੀ ਦਹੀ ਤੂੰ ਮੱਖਣ ਅਤੇ ਇਹਨਾਂ ਅਤੇ ਹੋਰ ਵੀ ਕਈ ਰੈਸਟੋਰੈਂਟ ਆ ਜੇ ਰੈਸਟੋਰੈਂਟਸ ਵੀ ਬੜੇ ਫੇ ਇਹ ਫੇਮਸ ਆ ਅੰਮ੍ਰਿਤਸਰ 'ਚ ਜਿੱਦਾਂ ਕਿ ਸਦਾ ਢਾਬਾ ਬ੍ਰਦਰਸ ਦਾ ਢਾਬਾ ਗੋਇੰਕਾ ਸਵੀਟਸ ਨੂੰ ਵਟੀ ਬਾਂਸਲ ਕਾਨ੍ਹਾ ਸਵੀਟਸ ਅਮ ਅ ਕਿ ਇਹ ਲੋਕ ਬਾਹਰੋਂ ਆਉਂਦੇ ਹਨ ਇੱਥੇ ਰੈ ਫੇਮਸ ਰੈਸਟੋਰੈਂਟ 'ਚ ਖਾਣ ਪੀਣ ਅਤੇ ਕੇਸਰ ਦਾ ਢਾਬਾ ਤਾਂ ਬਹੁਤ ਪੁਰਾਨਾ ਢਾਬਾ ਹੈ ਜੋ ਅੰਮ੍ਰਿਤਸਰ 'ਚ ਆ ਜੋ ਕਿ ਬਹੁਤ ਮਸ਼ਹੂਰ ਆ ਲੋਕ ਬਾਹਰੋਂ ਬਾਹਰੋਂ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਤਾਂ ਕੇਸਰ ਦਾ ਢਾਬੇ ਰੋ ਰੋਟੀ ਖਾ ਕੇ ਜ਼ਰੂਰ ਜਾਂਦੇ ਹਨ ਅਤੇ ਹੋਰ ਵੀ ਇੱਥੋਂ ਦੀ ਮਿਠਾਈਆਂ ਵੀ ਬਹੁਤ ਫੇਮਸ ਹਨ ਅਹੂਜਾ ਲੱਸੀ ਅਹੂਜਾ ਦੀ ਲੱਸੀ ਬਹੁਤ ਫੇਮਸ ਹਨ ਗਿਆਨੀ ਟੀ ਸਟੋਲ ਹੋਰ ਵੀ ਕਾਫੀ ਚੀਜ਼ਾਂ ਵਾ ਨਾ ਅੰਮ੍ਰਿਤਸਰ 'ਚ ਜੋ ਕਿ ਬਹੁਤ ਫੇਮਸ ਹਨ ਇੱਥੋਂ ਦੇ ਰੈਸਟੋਰੈਂਟਸ ਐਂਡ ਖਾਣ ਪੀਣ ਸਭ ਕੁਛ ਬਹੁਤ ਫੇਮਸ ਹਨ ਇੱਥੋਂ ਦੀ ਚੀਜ਼ਾਂ ਖਾਣ ਦਾ ਸਵਾਦ ਹੀ ਵੱਖਰਾ ਹੈ ਅਤੇ ਲੋਕ ਜਦੋਂ ਇੱਥੇ ਆਉਂਦੇ ਹਨ ਤਾਂ ਬਹੁਤ ਪਸੰਦ ਕਰਦੇ ਹਨ ਇੱਥੋਂ ਦੀਆਂ ਚੀਜ਼ਾਂ ਖਾ ਕੇ ਅਤੇ ਰੈਸਟੋਰੈਂਟ ਫੇਮਸ ਰੈਸਟੋਰੈਂਟ 'ਚ ਜਾਣ ਲਈ ਧੰਨਵਾਦ